ਮੇਰੀਆਂ ਉਮੀਦਾਂ ਦੇ ਮੁਤਾਬਿਕ ਇਸ ਵਾਰ ਚੋਣਾਂ ਹੋਈਆਂ ਚੋਣਾਂ ਦੇ ਵਿੱਚ ਖੇਤਰੀ ਪਾਰਟੀ ਨੂੰ ਛੱਡ ਕੇ ਬਾਹਰ ਦੀਆਂ ਪਾਰਟੀ ਨੂੰ ਜ਼ਿਆਦਾ ਵੋਟਾਂ ਮਿਲੀਆਂ ਮਤਲਬ ਉਹ ਪਹਿਲੇ ਦੂਜੇ ਸਥਾਨ 'ਤੇ ਆਈ ਦੂਜੇ ਸਥਾਨ 'ਤੇ ਆਈ ਇਸ ਚੀਜ਼ ਨੇ ਮੈਨੂੰ ਬੜਾ ਹੈਰਾਨ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਜੋ ਖੇਤਰੀ ਪਾਰਟੀਆਂ ਦੇ ਸਕਦੀਆਂ ਉਹ ਬਾਹਰ ਦੀਆਂ ਪਾਰਟੀਆਂ ਕਦੇ ਵੀ ਨਹੀਂ ਦੇ ਸਕਦੀਆਂ ਇੱਥੋਂ ਤੱਕ ਕੇ ਖੇਤਰੀ ਪਾਰਟੀਆਂ ਵੀ ਪੰਜਾਬ ਦੇ ਕੰਮ ਕਰਨ ਵਿੱਚ ਕੰਨੀ ਕਤਰਾਉਂਦੀਆਂ ਅਤੇ ਫਿਰ ਬਾਹਰ ਦੀਆਂ ਪਾਰਟੀਆਂ ਕਦੋਂ ਕੰਮ ਕਰਨਗੀਆਂ